ਪਾਣੀ ਪਾਣੀ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ ਸਾਨੂੰ ਸੁਬਹਾ ਸਵੇਰੇ ਜਲਦੀ ਉੱਠ ਕੇ ਪਾਣੀ ਪੀਣਾ ਚਾਹੀਦਾ ਹੈ ਅਗਰ ਅਸੀਂ ਸਵੇਰੇ ਕੋਸਾ ਪਾਣੀ ਪੀਂਦੇ ਹਾਂ ਤਾਂ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ ਪਾਣੀ ਰੋ ਪਾਣੀ ਬਿਨਾਂ ਸਾਡੇ ਸਰੀਰ ਵਿੱਚ ਕੋਈ ਵੀ ਕੰਮ ਅਸੰਭਵ ਹੈ ਪਾਣੀ ਰੋਟੀ ਰੋਟੀ ਤੋਂ ਪਹਿਲਾਂ ਅੱਧਾ ਘੰਟਾ ਪਾਣੀ ਪੀਣਾ ਚਾਹੀਦਾ ਹੈ ਰਾਤ ਨੂੰ ਸੋਣ ਵੇਲੇ ਪਾਣੀ ਪੀਣ ਨਾਲ ਵਾਸ਼ਰੂਮ ਜ਼ਿਆਦਾ ਆਉਂਦਾ ਹੈ ਇਸ ਲਈ ਸੋਣ ਤੋਂ ਪਹਿਲਾਂ ਥੋੜ੍ਹਾ ਘੱਟ ਪਾਣੀ ਪੀਣਾ ਚਾਹੀਦਾ ਹੈ ਘਰ ਵਿੱਚ ਵੀ ਪਾਣੀ ਤੋਂ ਬਿਨਾਂ ਅਸੀਂ ਕੁਛ ਨਹੀਂ ਕਰ ਸਕਦੇ ਹਰ ਕੰਮ ਪਾਣੀ ਦੇ ਨਾਲ ਹੀ ਸ਼ੁਰੂ ਹੁੰਦਾ ਹੈ ਸਫ਼ਾਈਆਂ ਵੀ ਅਸੀਂ ਪਾਣੀ ਨਾਲ ਹੀ ਕਰ ਸਕਦੇ ਹਾਂ ਬਰਤਨ ਵੀ ਅਸੀਂ ਪਾਣੀ ਨਾਲ ਧੋਂਦੇ ਹਾਂ ਹਰ ਕੰਮ ਵਿੱਚ ਪਾਣੀ ਦੀ ਜ਼ਰੂਰਤ ਵੱਧ ਤੋਂ ਵੱਧ ਹੈ ਅਗਰ ਗਰਮੀਆਂ ਵਿੱਚ ਪਾਣੀ ਨਹੀਂ ਆਉਂਦਾ ਤਾਂ ਸਾਨੂੰ ਰਹਿਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਪਾਣੀ ਤੋਂ ਬਿਨਾਂ ਸਾਡੇ ਜੀਵਨ ਵਿੱਚ ਕੁਛ ਵੀ ਨਹੀਂ ਹੈ ਪਾਣੀ ਪਾਣੀ ਹਰ ਗੱਲ ਵਿੱਚ ਪਾਣੀ ਦੀ ਮਾਤਰਾ ਹਰ ਸਮੇਂ ਜ਼ਰੂਰੀ ਹੈ ਅਗਰ ਪਾਣੀ ਨਾ ਹੋਵੇ ਤਾਂ ਜਾਨਵਰ ਵੀ ਪਾਣੀ ਤੋਂ ਬਿਨਾਂ ਤੜਫ਼ ਤੜਫ਼ ਕੇ ਮਰ ਜਾਂਦੇ ਹਨ ਜਾਨਵਰਾਂ ਨੂੰ ਵੀ ਪਾਣੀ ਬਹੁਤ ਜ਼ਰੂਰੀ ਹੈ ਗਰਮੀਆਂ ਵਿੱਚ ਤਾਂ ਪਾਣੀ ਦੀ ਬਹੁਤ ਜ਼ਰੂਰਤ ਪੈਂਦੀ ਹੈ